ਸਾਡੇ ਖੇਤਰ ਵਿੱਚ ਕਬਾਇਲੀ ਕਲਾਵਾਂ ਨੂੰ ਸਾਡੇ ਗਾਣਿਆਂ ਦੇ ਰੂਪ ਵਿੱਚ ਸਾਂਭਿਆ ਗਿਆ ਹੈ ਸਾਡੇ ਧਾਰਮਿਕ ਅਸਥਾਨਾਂ ਵਿੱਚ ਜਿਵੇਂ ਕਿ ਪੀਰ ਦੀ ਜਗ੍ਹਾ ਹੋ ਗਈ ਉਹਨਾਂ ਵਿੱਚ ਜੋ ਕਿ ਗਾਣੇ ਲੱਗਦੇ ਹਨ ਉਹ ਕਵਾਲੀ ਦੇ ਥਰੂ ਹੀ ਗਾਏ ਗਏ ਹਨ ਅਤੇ ਲੋਕ ਮੈਕਸੀਮਮ ਜੋ ਕਿ ਕਵਾਲੀਆਂ ਹੀ ਗਾਉਂਦੇ ਹਨ ਜੋ ਸਾਡੇ ਪੀਰਾਂ ਦੀ ਜਗ੍ਹਾ 'ਤੇ ਜਾਂ ਫਿਰ ਉਹਨਾਂ ਦੇ ਮਹੱਤਵਪੂਰਨ ਜੋ ਦਿਨ ਆਉਂਦੇ ਹਨ ਉਹਨਾਂ ਵਿੱਚ ਕਵਾਲੀ ਦੇ ਗਾਣੇ ਹੀ ਲੱਗਦੇ ਹਨ ਅਤੇ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਸਾਡੀ ਕਵਾਲੀ ਹੈ ਉਹ ਸਾਡੇ ਧਾਰਮਿਕ ਅਸਥਾਨਾਂ ਦੇ ਵਿੱਚ ਅਸੀਂ ਸੰਭਾਲਦੇ ਹਾਂ ਅਤੇ ਉਹਨਾਂ ਨੂੰ ਗਾਣਿਆਂ ਦੇ ਰੂਪ ਵਿੱਚ ਦੇ ਕੇ ਅਸੀਂ ਸਾਂਭ ਕੇ ਰੱਖਿਆ ਹੋਇਆ ਹੈ